ਪਰਸੋਂ ਮੈਨੂੰ ਦਿੱਲੀ ਜਾਣ ਦੀ ਜਰੂਰਤ ਪੈ ਗਈ ਜਿਸ ਨਾਲ ਸਬੰਧਤ ਮੈਂ ਆਪਣੇ ਨੇੜੇ ਦੇ ਕਪੂਰਥਲਾ ਰੇਲਵੇ ਸਟੇਸ਼ਨ ਤੇ ਗਿਆ ਤੇ ਉੱਥੇ ਰੇਲ ਗੱਡੀ ਰਾਹੀਂ ਯਾਤਰਾ ਲਈ ਰੇਲ ਗੱਡੀਆਂ ਦੀ ਜਾਣਕਾਰੀ ਇਸ ਸਮੇਂ ਦਾ ਵੇਰਵਾ ਲਿਆ ਜਿਸ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਨੂੰ ਦਿੱਲੀ ਦਾ ਇੱਕ ਲੰਬਾ ਸਫਰ ਇਸ ਲਈ ਇਸ ਦੀ ਪਹਿਲਾਂ ਤੋਂ ਹੀ ਬੁਕਿੰਗ ਕਰਵਾਉਣੀ ਪੈਂਦੀ ਹੈ ਬੁਕਿੰਗ ਕਰਵਾਉਣ ਲਈ ਉਹਨਾਂ ਨੇ ਮੈਨੂੰ ਇੱਕ ਫਾਰਮ ਭਰਨ ਨੂੰ ਦਿੱਤਾ ਜਿਸ ਉੱਤੇ ਲਿਖਿਆ ਸੀ ਆਧਾਰ ਕਾਰਡ ਨੰਬਰ ਜਰੂਰੀ ਸੀ ਮੇਰੇ ਕੋਲ ਆਧਾਰ ਕਾਰਡ ਸੀ ਮੈਂ ਆਪਣਾ ਆਧਾਰ ਕਾਰਡ ਦਾ ਨੰਬਰ ਭਰਿਆ ਅਤੇ ਹੋਰ ਆਪਣੀ ਉਮਰ ਵਗੈਰਾ ਨਾਮ ਪਤਾ ਐਡਰੈਸ ਵਗੈਰਾ ਫਿਲ ਕੀਤਾ ਸਾਰੀਆਂ ਫੋਰਮੈਲਿਟੀਜ ਪੂਰੀ ਕਰਨ ਤੋਂ ਬਾਅਦ ਮੈਂ ਰੇਲਵੇ ਦੀ ਟਿਕਟ ਆਪਣੀ ਬੁੱਕ ਕਰ ਦਿੱਤੀ ਤੇ ਭੁਗਤਾਨ ਕਰ ਦਿੱਤਾ ਪ੍ਰੰਤੂ ਜਦੋਂ ਮੈਂ ਰਵਾਨਗੀ ਲਈ ਕੱਲ ਜਾਣਾ ਸੀ ਤਾਂ ਮੇਰਾ ਪਲੈਨ ਚੇਂਜ ਹੋ ਗਿਆ ਜਿਸ ਲਈ ਮੈਨੂੰ ਰੇਲਵੇ ਤੋਂ ਸ਼ਮਾ ਮੰਗਣੀ ਪਈ ਪ੍ਰੰਤੂ ਮੈਂ ਆਪਣੀ ਰੇਲਵੇ ਦੀ ਪ੍ਰੀ ਬੁਕਿੰਗ ਟਿਕਟ ਨੂੰ ਰੱਦ ਕਰਨਾ ਚਾਹੁੰਦਾ ਸੀ ਰੱਦ ਕਰਨ ਲਈ ਮੈਂ ਫਿਰ ਤੋਂ ਨੇੜ ਦੇ ਰੇਲਵੇ ਸਟੇਸ਼ਨ ਕਪੂਰਥਲਾ ਸਟੇਸ਼ਨ ਤੇ ਹੀ ਗਿਆ ਤੇ ਉਹਨਾਂ ਨੂੰ ਆਪਣੀ ਸਾਰੀ ਸਮੱਸਿਆ ਦੱਸੀ ਕਿ ਪਹਿਲਾਂ ਮੈਂ ਦਿੱਲੀ ਜਾਣਾ ਸੀ ਫਿਰ ਮੇਰਾ ਬਿਨਾਂ ਜਾਏ ਤੋਂ ਹੀ ਸਰ ਗਿਆ ਫਿਰ ਮੈਂ ਕੀ ਲੈਣ ਜਾਣਾ ਹੈ ਇਸ ਲਈ ਮੇਰੀ ਟਿਕਟ ਰੱਦ ਕਰ ਦਿੱਤੀ ਜਾਵੇ ਮੈਂ ਇਸ ਸਫਰ ਵਿੱਚ ਸਫਰ ਕਰਨ ਦਾ ਆਸ਼ਾਵਾਦੀ ਨਹੀਂ ਹਾਂ ਉਹਨਾਂ ਨੇ ਮੇਰੀ ਬੇਨਤੀ ਸਵੀਕਾਰ ਕੀਤੀ ਤੇ ਮੈਨੂੰ ਇੱਕ ਹੋਰ ਫਾਰਮ ਭਰਨ ਲਈ ਦਿੱਤਾ ਉਸ ਫਾਰਮ ਤੇ ਮੈਂ ਆਪਣੀ ਪਰਸਨਲ ਡਿਟੇਲਸ ਜਿੱਦਾਂ ਨਾਮ ਪਤਾ ਉਮਰ ਆਦੀ ਫਿਲ ਕੀਤੀ ਆਪਣਾ ਆਧਾਰ ਕਾਰਡ ਦਾ ਨੰਬਰ ਫਿੱਲ ਕੀਤਾ ਫਿਰ ਉਹਨਾਂ ਨੇ ਉਥੇ ਲਿਖਿਆ ਸੀ ਕਾਰਨ ਫਿਰ ਮੈਂ ਉਸ ਕਾਰਨ ਦੀ ਜਗ੍ਹਾ ਜਰਨੀ ਕੈਂਸਲ ਦੇ ਕਾਰਨ ਦੀ ਜਗ੍ਹਾ ਆਪਣੀ ਜਿਹੜੀ ਸਥਿਤੀ ਸੀ ਉਹ ਫਿਲ ਕੀਤੀ ਮੇਰੀ ਸਥਿਤੀ ਨੂੰ ਸਮਝਦਿਆਂ ਮੈਂ ਉਸ ਫਾਰਮ ਨੂੰ ਰੇਲਵੇ ਦੇ ਕਲੈਕਟਰ ਕੋਲ ਜਮਾਂ ਕਰਵਾ ਦਿੱਤਾ ਮੇਰੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦਿਆਂ ਉਹਨਾਂ ਨੇ ਬੇਨਤੀ ਸਵੀਕਾਰ ਕਰ ਲਈ ਤੇ ਉਹ ਫਾਰਮ ਸਵੀਕਾਰ ਕਰ ਲਿਆ ਉਸ ਉਪਰੰਤ ਉਹਨਾਂ ਨੇ ਮੈਤੋਂ ਮੇਰੇ ਬੈਂਕ ਅਕਾਊਂਟ ਦੀ ਡਿਟੇਲ ਜਾਂ ਯੂ ਪੀ ਆਡੀ ਡੀ ਮੰਗੀ ਮੈਂ ਆਪਣੇ ਬੈਂਕ ਅਕਾਊਂਟ ਦੀ ਡਿਟੇਲ ਦਿੱਤੀ ਤੇ ਉਹਨਾਂ ਨੇ ਮੈਨੂੰ ਯਕੀਨੀ ਬਣਾਇਆ ਕੀ ਅਠਾਰਾਂ ਘੰਟੇ ਦੇ ਵਿੱਚ ਵਿੱਚ ਤੁਹਾਡੀ ਭੁਗਤਾਨ ਕੀਤੀ ਹੋਈ ਸਾਰੀ ਰਾਸ਼ੀ ਤੁਹਾਡੇ ਖਾਤੇ ਵਿੱਚ ਦੁਬਾਰਾ ਤੋਂ ਵਾਪਸ ਕਰ ਦਿੱਤੀ ਜਾਏਗੀ ਇਹ ਸਹੂਲਤ ਮੁਹੱਈਆ ਕਰਾਉਣ ਲਈ ਮੈ ਇਹ ਸਰਕਾਰ ਦਾ ਤੇ ਰੇਲਵੇ ਵਿਭਾਗ ਦਾ ਧੰਨਵਾਦੀ ਹਾਂ ਮੈਨੂੰ ਬਹੁਤ ਹੀ ਪਰੇਸ਼ਾਨੀ ਹੋ ਗਈ ਸੀ ਕਿਉਂਕਿ ਰੇਲਵੇ ਦੀ ਟਿਕਟ ਕਾਫੀ ਮਹਿੰਗੀ ਹੈ ਇੱਕ ਆਮ ਵਿਅਕਤੀ ਲਈ ਇਹ ਕਰਾਇਆ ਮਾਇਨੇ ਰੱਖਦਾ ਹੈ ਜਿਸ ਉਪਰੰਤ ਉਹਨਾਂ ਵੱਲੋਂ ਵਾਪਸ ਭੁਗਤਾਨ ਨਾਲ ਮੇਰੀ ਰੂਹ ਖੁਸ਼ ਖਿੜ ਗਈ